ਹੈਲੋ ਮੈਮ ਸਤਿ ਸ਼੍ਰੀ ਅਕਾਲ ਮੈਮ ਮੈਡਮ ਮੈਂ ਨਾ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਸਤੇ ਆਉਣਾ ਚਾਹੁੰਦਾ ਵਾਂ ਮੈਨੂੰ ਦੱਸੋ ਕਿ ਕੀ ਹੈਗਾ ਵਾ ਤਿੰਨ ਦਿਨ ਵਾਸਤੇ ਅੱਛਾ ਤੁਸੀਂ ਦਸ ਹਜ਼ਾਰ ਵਿੱਚ ਤੁਸੀਂ ਮੈਨੂੰ ਕੀ ਅੰਮ੍ਰਿਤਸਰ ਵਿੱਚ ਕੀ ਕੀ ਕੁਛ ਦਿਖਾਉਂਗੇ ਹਾਂਜੀ ਮੈਡਮ ਅੱਛਾ ਏ ਠੀਕ ਹੈ ਮੈਡਮ ਮੈਂ ਮੈਂ ਨਾ ਤੁਹਾਨੂੰ ਐਡਵਾਂਸ ਪੇਮੈਂਟ ਮ ਕਲੋਨਾ ਵਾਂ ਕਿਰਪਾ ਕਰਕੇ ਮੇਰਾ ਨਾ ਇਹ ਟੂਰ ਬੁੱਕ ਕਰ ਕਰ ਦਿਓ ਠੀਕ ਹੈ ਮੈਡਮ ਥੈ ਧੰਨਵਾਦ